ਹੈਲੋ ਹਾਂਜੀ ਹਾਂਜੀ ਦੱਸੋ ਜੀ ਹਾਂਜੀ ਪੁੱਛੋ ਜੀ ਠੀਕ ਹੈ ਜੀ ਸਾਡੀ ਦੁਕਾਨ 'ਤੇ ਜੀ ਬਹੁਤ ਤਰ੍ਹਾਂ ਦੇ ਫ਼ਰੂਟ ਮਿਲਦੇ ਹੈ ਜੀ ਜਿਵੇਂ ਕਿ ਸੱਤ ਅੱਠ ਤਰ੍ਹਾਂ ਦੇ ਜੀ ਜਿਵੇਂ ਕਿ ਬਨਾਨਾਸ ਹੋ ਗਏ ਜੀ ਅਤੇ ਸੇਬ ਹੋ ਗਏ ਹੈ ਨਾ ਜੀ ਪਾਈਨਐਪਲਜ਼ ਹੋ ਗਏ ਅਤੇ ਜਿੱਦਾਂ ਹੋਰ ਵੀ ਮਤਲਬ ਸੰਗਤਰੇ ਵਗੈਰਾ ਹੋ ਗਏ ਕਿੰਨੂ ਪਪੀਤਾ ਹੋ ਗਿਆ ਜੀ ਅਤੇ ਸਾਰਿਆਂ ਦਾ ਰੇਟ ਅਲੱਗ ਅਲੱਗ ਹੈ ਜੀ ਅਤੇ ਕੋਆਲੀਟੀ ਇਹਨਾਂ ਦੀ ਆਪਾਂ ਹਾਂਜੀ ਹਾਂ ਭਾਅ ਜੀ ਫਰੈਸ਼ ਫਰੂਟ ਹੁੰਦਾ ਹੈ ਜਿਵੇਂ ਕਿ ਆਪਣੇ ਕੋਲ ਬਾਹਰ ਤੋਂ ਇੰਮਪੋਰਟਡ ਫਰੂਟ ਆਉਂਦੇ ਹੈ ਅਤੇ ਆਪਾਂ ਡੇਲੀ ਦੀ ਡੇਲੀ ਓ ਲੈ ਕੇ ਆਉਂਦੇ ਹਾਂ ਆਪਾਂ ਓਨੀਂ ਕੁ ਕੋਆਨਟੀਟੀ ਲੈ ਕੇ ਆਉਂਦੇ ਹਾਂ ਜਿੰਨੀ ਕੁ ਕਿ ਆਪਣੀ ਸੇਲ ਹੋ ਜਾਵੇ ਡੇਲੀ ਆਪਾਂ ਹੋਰ ਦੁਕਾਨਦਾਰਾਂ ਵਾਗੂੰ ਨਹੀਂ ਜੀ ਵੀ ਜਿਵੇਂ ਕਿ ਕਹਿ ਲਉ ਵੀ ਇੱਕ ਦਿਨ ਦਾ ਲਿਆ ਕੇ ਦੂਜੇ ਦਿਨ ਸਟੇਲ ਸਟਾਲ ਫਰੂਟ ਵੇਚਦੇ ਹਾਂ ਉਹ ਚੀਜ਼ ਨਹੀਂ ਹੈਗੀ ਜੀ ਆਪਣੇ ਕੋਲ ਹਾਂਜੀ ਹਾਂ ਰੇਟ ਤਾਂ ਜੀ ਐਕਪੈਨਸਿਵ ਹੈ ਕਿਉੰਕਿ ਸਾਡੇ ਕੋਲ ਜੀ ਸਾਰੇ ਹੀ ਇੰਮਪੋਰਟਡ ਫਰੂਟ ਹੁੰਦੇ ਹੈ ਜੀ ਜਿਵੇਂ ਕਿ ਅਸੀਂ ਸਾਰੇ ਫਰੂਟ ਜੀ ਬਾਹਰੋਂ ਮੰਗਵਾਉਂਦੇ ਹਾਂ ਅਸੀਂ ਕੋਈ ਵੀ ਲੌਕਲ ਮਾਰਕਾ ਨਹੀਂ ਰੱਖਦੇ ਜੀ ਨਹੀਂ ਸਰ ਉਹ ਸਾਡੇ ਕੋਲ ਇੱਕ ਏ ਕੈਟਾਗਰੀ 'ਚ ਹੈ ਜਿਵੇਂ ਕਿ ਸਿੰਪਲ ਬਨਾਨਾਸ ਉਹ ਬੱਸ ਇੱਦਾਂ ਕ ਕਿ ਉਹ ਇੰਮਪੋਰਟੇਡ ਹੈ ਉਹਦਾ ਇਹ ਫਰਕ ਹੈ ਇਸ ਲਈ ਥੋੜ੍ਹੀ ਜਿਹੀ ਉਹਦੀ ਕੋਸਟ ਜ਼ਿਆਦਾ ਵੈਰੀ ਕਰਦੀ ਆਪਾਂ ਨੂੰ ਅਸੀਂ ਔਨਲਾਈਨ ਡਿਲੀਵਰ ਕਰ ਦਿੰਦੇ ਹਾਂ ਜੀ ਜਿਵੇਂ ਕਿ ਈਕਾਰਟ ਹੋ ਗਈ ਆਪਣੇ ਕੋਲ ਹੋਰ ਵੀ ਕਈ ਕੰਪਨੀਆਂ ਆਪਾਂ ਉਹਨਾਂ ਦੇ ਥਰੁਅ ਅਤੇ ਆਪਾਂ ਆਪਣੇ ਲੋਕਲ ਮੁੰਡੇ ਵੀ ਰੱਖੇ ਹੋਏ ਹੈ ਜਿਨ੍ਹਾਂ ਨਾਲ ਕਿ ਆਪਾਂ ਤੁਸੀਂ ਫਰੂਟ ਮੰਗਵਾਉ ਅਤੇ ਆਪਾਂ ਤੁਹਾਡੇ ਘਰ ਡਿਲੀਵਰ ਕਰ ਦਾਗੇ ਜੀ ਠੀਕ ਹੈ ਜੀ ਧੰਨਵਾਦ ਸਰ